ਤਰਨਤਾਰਨ ਸ਼ਹਿਰ ਦੇ ਨਾਲ ਲੱਗਦਾ ਜ਼ਿਲ੍ਹਾ ਅੰਮ੍ਰਿਤਸਰ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹੈ ਇਹ ਸੈਰ ਸਪਾਟਾ ਉਦਯੋਗ ਵਿੱਚ ਬਹੁਤ ਵਧੀਆ ਭੂਮਿਕਾ ਅਦਾ ਕਰਦਾ ਹੈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਸੈਲਾਨੀਆਂ ਦੀ ਖਿੱਚ ਦਾ ਮੂਲ ਕੇਂਦਰ ਹੈ ਤਰਨ ਤਾਰਨ ਜੋ ਕਿ ਘੱਟ ਦਰਜੇ ਵਾਲਾ ਖੇਤਰ ਹੈ ਨੂੰ ਸੈਰ ਸਪਾਟਾ ਉਦਯੋਗ ਵਿੱਚ ਪ੍ਰਫੁੱਲਿਤ ਕਰਨ ਲਈ ਰਾਜ ਸਰਕਾਰ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਹਨ ਕੇਂਦਰ ਸਰਕਾਰ ਵੱਲੋਂ ਗੁਜਰਾਤ ਵਿੱਚ ਲਿਆ ਗਿਆ ਕਦਮ ਜਿਸ ਦੇ ਅੰਤਰਗਤ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਬਣਵਾਈ ਗਈ ਸੀ ਇਹ ਵੀ ਸੈਰ ਸਪਾਟੇ ਉਦਯੋਗ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਕੁਝ ਅਜਿਹੇ ਖੇਤਰ ਹਨ ਜੋ ਸੁੰਦਰ ਤਾਂ ਹਨ ਪਰ ਪ੍ਰਸਿੱਧ ਨਹੀਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਦਾ ਕੰਪਨੀ ਬਾਗ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਹੈ ਇਹ ਅਜਿਹੇ ਖੇਤਰਾਂ ਦੀ ਉਦਾਹਰਣ ਹੈ ਜੋ ਸੈਰ ਸਪਾਟੇ ਲਈ ਵਧੀਆ ਸਾਬਿਤ ਹੋ ਸਕਦੇ ਹਨ ਜੇਕਰ ਇਹਨਾਂ ਦੀ ਪ੍ਰਸਿੱਧੀ ਵੱਲ ਧਿਆਨ ਦਿੱਤਾ ਜਾਵੇ